ਕਾਨੂੰਨੀ ਦਸਤਾਵੇਜ਼ ਬਣਾਉਣੇ ਹਰ ਇੱਕ ਆਮ ਜਨਤਾ ਲਈ ਹਰ ਇੱਕ ਜੋ ਦੇਸ਼ ਦਾ ਨਾਗਰਿਕ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ ਕਾਨੂੰਨੀ ਦਸਤਾਵੇਜ਼ ਬਣਾਉਣ ਵਿੱਚ ਮੇਰਾ ਅਨੁਭਵ ਬਹੁਤ ਜ਼ਿਆਦਾ ਮਾੜਾ ਰਿਹਾ ਏ ਕਿਉਂਕਿ ਇਹ ਬਹੁਤ ਮੁਸ਼ਕਿਲ ਕੰਮ ਹੈ ਸਾਨੂੰ ਜਾ ਕੇ ਤਹਿਸੀਲ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਫਿਰ ਉੱਥੇ ਜਾ ਕੇ ਟੋਕਨ ਲੈਣੇ ਪੈਂਦੇ ਨੇ ਸੁਵਿਧਾ ਕੇਂਦਰਾਂ 'ਚ ਜਾ ਕੇ ਲੰਬੀਆਂ ਲੰਬੀਆਂ ਕਤਾਰਾਂ 'ਚ ਲੱਗਣਾ ਪੈਂਦਾ ਫਿਰ ਉੱਥੇ ਜਾ ਕੇ ਉੱਥੇ ਵੀ ਟੋਕਨ ਲਓ ਉੱਤੇ ਫਿਰ ਜਦੋਂ ਜਦੋਂ ਬਾਰੀ ਆਉਂਦੀ ਆ ਉਦੋਂ ਤੱਕ ਕਹਿ ਦਿੰਦੇ ਜੀ ਸਾਡਾ ਤਾਂ ਜੀ ਲੰਚ ਟਾਈਮ ਹੋ ਗਿਆ ਤੁਸੀਂ ਲੰਚ ਟਾਈਮ ਤੋਂ ਬਾਅਦ ਆਇਓ ਫਿਰ ਸ਼ਾਮ ਤੱਕ ਵੇਟ ਕਰਨੀ ਪੈਂਦੀ ਹੈ ਫਿਰ ਜਦੋਂ ਉਹ ਉੱਥੇ ਜਾ ਕੇ ਔਨਲਾਈਨ ਬਣ ਜਾਂਦਾ ਜਾਂ ਫਿਰ ਲਿਖਤੀ ਰੂਪ 'ਚ ਬਣਾਉਂਦੇ ਨੇ ਫਿਰ ਜਦੋਂ ਕਿਤੇ ਤਹਿਸੀਲਦਾਰ ਸਾਹਿਬ ਦੀ ਸਟੈਂਪ ਲੱਗਣੀ ਹੁੰਦੀ ਹੈ ਤਾਂ ਕਹਿ ਦਿੰਦੇ ਜੀ ਤਹਿਸੀਲਦਾਰ ਸਾਹਿਬ ਤਾਂ ਉੱਠ ਕੇ ਚਲੇ ਗਏ ਨੇ ਤਹਿਸੀਲਦਾਰ ਸਾਹਿਬ ਅੱਜ ਛੁੱਟੀ 'ਤੇ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਦਸਤਾਵੇਜ਼ ਪ੍ਰਾਪਤ ਕਰਨ ਲਈ ਸੁਵਿਧਾ ਕੇਂਦਰਾਂ 'ਚ ਜਾਣਾ ਪੈਂਦਾ ਸਾਂਝ ਕੇਂਦਰਾਂ ਜਾਣਾ ਪੈਂਦਾ ਹੈ ਜਾਂ ਫਿਰ ਤਹਸੀਲਦਾਰ ਆਫਿਸ 'ਚ ਜਾਣਾ ਪੈਂਦਾ ਉੱਥੇ ਜਾ ਕੇ ਪਹਿਲਾਂ ਤਾਂ ਜਿਹੜੇ ਉਹਨਾਂ ਦੇ ਉੱਥੇ ਅੱਗੇ ਕਰਮਚਾਰੀ ਨੇ ਜੋ ਉਹਨਾਂ ਦੇ ਉਹਨਾਂ ਦਾ ਵਿਵਹਾਰ ਵੀ ਬਹੁਤ ਸਾਰੇ ਕਰਮਚਾਰੀ ਇੱਦਾਂ ਦੇ ਨੇ ਜਿਨ੍ਹਾਂ ਦਾ ਵਿਵਹਾਰ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾ ਰੁੱਖਾਪਨ ਹੁੰਦਾ ਉਹਨਾਂ ਦੇ ਵਿਵਹਾਰ 'ਚ ਉਹ ਇੱਦਾਂ ਬੋਲਦੇ ਨੇ ਜਿੱਦਾਂ ਕਿ ਅਸੀਂ ਕੋਈ ਕ੍ਰਾਈਮ ਕਰਕੇ ਉੱਥੇ ਗਏ ਹੁੰਦੇ ਹਾਂ ਅਸੀਂ ਤਾਂ ਆਪਣੇ ਦਸਤਾਵੇਜ਼ ਸਾਨੂੰ ਲੋੜ ਹੈ ਸਾਨੂੰ ਉਸ ਚੀਜ਼ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਉੱਥੇ ਬਣਵਾਉਣ ਜਾਂਦੇ ਨੇ ਪਰ ਉਹ ਸਾਨੂੰ ਅੱਗੇ ਤੋਂ ਇੱਦਾਂ ਬੋਲਦੇ ਨੇ ਕਿ ਨਹੀਂ ਜੀ ਕਾਲੂ ਆਇਓ ਜੀ ਪਰਸੋਂ ਨੂੰ ਆਇਓ ਜੀ ਤਹਿਸੀਲਦਾਰ ਸਾਹਿਬ ਛੁੱਟੀ 'ਤੇ ਨੇ ਪਟਵਾਰੀ ਸਾਹਿਬ ਛੁੱਟੀ 'ਤੇ ਨੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਇੱਕ ਜਦੋਂ ਫਿਰ ਕਿਤੇ ਬਣਾਉਣੇ ਪੈਂਦੇ ਨੇ ਕਾਨੂੰਨੀ ਦਸਤਾਵੇਜ਼ ਤਾਂ ਫਿਰ ਇਹ ਹੁੰਦਾ ਵੀ ਕਿਉਂ ਜਾਈਏ ਬਣਾਉਣਾ ਪਰ ਇੱਕ ਜ਼ਰੂਰਤ ਹੈ ਤਾਂ ਬਣਵਾਉਣੇ ਪੈਂਦੇ ਨੇ ਜਿਹੜੇ ਦਸਤਾਵੇਜ਼ ਬਣਾਉਣੇ ਔਖੇ ਨੇ ਉਹ ਜਿਵੇਂ ਕਿ ਆਧਾਰ ਕਾਰਡ ਹੈ ਆਧਾਰ ਕਾਰਡ 'ਤੇ ਕਈ ਵਾਰ ਤਾਂ ਫੋਟੋ ਹੀ ਨਹੀਂ ਸਹੀ ਆਉਂਦੀ ਫਿਰ ਸਾਰੇ ਬੋਲਦੇ ਨੇ ਆ ਤੁਹਾਡੀ ਫੋਟੋ ਨਹੀਂ ਸਹੀ ਹੈਗੀ ਤੁਹਾਡਾ ਅਪਡੇਟ ਨਹੀਂ ਹੈਗਾ ਈਵਨ ਤੁਸੀਂ ਅਪਡੇਟ ਵੀ ਕਰਵਾਓ ਤਾਂ ਵੀ ਕਹਿੰਦੇ ਅਪਡੇਟ ਨਹੀਂ ਹੈਗਾ ਇਸ ਤਰ੍ਹਾਂ ਫਿਰ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਕਈ ਵਾਰ ਫਿੰਗਰਜ਼ ਦੇ ਜਿਹੜੇ ਉਹ ਫਿੰਗਰ ਸੈਂਸਰ ਲੈਂਦੇ ਨੇ ਉਹ ਫਿੰਗਰ ਦੇ ਸੈਂਸਰ ਹੀ ਨਹੀਂ ਮੈਚ ਕਰਦੇ ਫਿਰ ਉੱਥੇ ਵੀ ਮੁਸ਼ਕਿਲਾਂ ਆਉਂਦੀਆਂ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਨੇ ਕਾਨੂੰਨੀ ਦਸਤਾਵੇਜ਼ ਬਣਾਉਣ ਵਿੱਚ